ਹਾਂਜੀ ਮੈਂ ਆਪਣੇ ਕਿਸੇ ਖ਼ਾਸ ਲਈ ਕੋਈ ਕਾਵਿ ਲਿਖਿਆ ਹੈ ਇਹ ਕਾਵਿ ਮੈਂ ਆਪਣੇ ਚਚੇਰੀ ਭੈਣ ਦੇ ਵਿਆਹ 'ਤੇ ਉਸਨੂੰ ਅਤੇ ਉਸਦੇ ਪਤੀ ਨੂੰ ਇੱਕ ਸਿੱਖਿਆ ਵਜੋਂ ਲਿਖਿਆ ਹੈ ਜਿਸ ਵਿੱਚ ਆਪਣੀ ਭੈਣ ਨੂੰ ਇੱਕ ਸਿੱਖਿਆ ਦਿੰਦੇ ਹੋਏ ਕਿਹਾ ਹੈ ਕਿ ਉਸਨੇ ਆਪਣੀ ਨਵੀਂ ਜ਼ਿੰਦਗੀ ਦੀ ਕਿਵੇਂ ਸ਼ੁਰੂਆਤ ਕਰਨੀ ਹੈ ਅਤੇ ਆਪਣੇ ਨਵੇਂ ਘਰ ਪਰਿਵਾਰ ਦੀ ਕਿਵੇਂ ਸਾਂਭ ਸੰਭਾਲ ਇੱਜਤ ਦਾ ਖਿਆਲ ਰੱਖਣਾ ਹੈ ਅਤੇ ਆਏ ਗਏ ਦਾ ਕਿਵੇਂ ਧਿਆਨ ਰੱਖਣਾ ਹੈ ਉਸ ਦੇ ਪਤੀ ਨੂੰ ਵੀ ਇਸ ਕਾਵਿ ਰਾਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਨੂੰ ਨੂੰ ਇੱਜਤ ਅਤੇ ਮਾਣ ਸਨਮਾਨ ਦੇਣਾ ਹੈ ਕਿ ਦੋਵਾਂ ਨੇ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਰਲ ਕੇ ਆਉਣ ਵਾਲੇ ਉਤਾਰ ਚੜਾਅ ਦਾ ਕਿਵੇਂ ਸਾਹਮਣਾ ਕਰਨਾ ਇੱਕ ਦੂਜੇ ਦਾ ਸਾਥ ਕਿਵੇਂ ਦੇਣਾ ਹੈ ਇਹ ਮੇਰੇ ਦੁਆਰਾ ਲਿਖੀ ਹੋਈ ਕਵਿਤਾ ਉਸ ਨੂੰ ਬਹੁਤ ਪਸੰਦ ਆਈ ਉਸਨੇ ਕਿਹਾ ਕਿ ਅਸੀਂ ਘਲ ਗੱਲ ਦਾ ਖ਼ਾਸ ਧਿਆਨ ਰੱਖਾਂਗੇ ਅਤੇ ਬਹੁਤ ਇਸ ਕਾ ਕਾਵਿ ਤੋਂ ਬਹੁਤ ਖੁਸ਼ ਹੋਏ